ਬਾਈ ਪਿਛਲੇ ਦਿਨੀਂ ਮੈਂ ਮੰਗਵਾਇਆ ਤਾ ਜਾਣੀ ਕਿ ਆਪਣਾ ਲੰਚ ਮੰਗਵਾਇਆ ਆਪਣੇ ਮਜਨੂੰ ਢਾਬੇ ਤੋਂ ਬੜੀ ਵਧੀਆ ਸਰਵਿਸ ਹੈ ਯਾਰ ਉਨ੍ਹਾਂ ਦੀ ਉੱਦਣ ਮੀਂਹ ਵੀ ਬਹੁਤ ਪਵੇ ਪਰ ਪਤੰਦਰਾਂ ਨੇ ਫਿਰ ਵੀ ਟਾਈਮ ਸਿਰ ਪੁੱਜਦਾ ਕਰ ਤਿਆ ਰੋਟੀ ਪਾਣੀ ਮੈਨੂੰ ਉਮੀਦ ਜਾਣੀ ਕਿ ਹੈ ਨਹੀਂ ਤੀ ਉੱਦਣ ਉੱਦਣ ਚੱਕਰ ਐਂ ਪੈ ਗਿਆ ਘਰਾਂ ਕੋਈ ਹੈ ਨਹੀਂ ਤਾ ਮੁੰਡੇ ਤਿੰਨ ਚਾਰ ਇਕੱਠੇ ਹੋ ਗਏ ਮੈਨੂੰ ਐਂ ਬਈ ਚੱਲ ਅੱਜ ਢਾਬੇ ਤੋਂ ਮੰਗਵਾ ਲਈਏ ਉੱਦਣ ਹੀ ਮੀਂਹ ਉੱਤਰ ਆਇਆ ਪਰ ਬਾਈ ਫਿਰ ਵੀ ਮੀਂਹ ਮੂਹ 'ਚ ਵੀ ਜਾਣੀ ਕਿ ਉਹ ਬੰਦੇ ਪਿੱਛੇ ਨਹੀਂ ਹੱਟਦੇ ਕੰਮ ਪੂਰਾ ਰੀਝ ਨਾਲ ਕਰਦੇ ਹੈ ਅਤੇ ਬਾਕੀ ਮੈਂ ਜਾਣੀ ਕਿ ਦਾਲ ਮੱਖਣੀ ਮੰਗਾਈ ਤੀ ਪਨੀਰ ਦੀ ਭੁਰਜੀ ਮੰਗਾਈ ਤੀ ਨਾਲ ਬੂੰਦੀ ਰਾਇਤਾ ਤਾ ਉਹ ਤੋਂ ਇਲਾਵਾ ਜਲੇਬੀਆਂ ਮੰਗਵਾਈਆਂ ਤੀਆਂ ਗਰਮ ਗੁਲਾਬ ਜਾਮਣਾਂ ਮੰਗਵਾਈਆਂ ਤੀਆਂ ਉਹ ਤੋਂ ਬਿਨਾਂ ਆਪਣਾ ਆਹ ਪਾਲਕ ਪਨੀਰ ਮੰਗਵਾਇਆ ਤਾ ਇੱਕ ਆਪਣੀ ਉਹ ਮੰਗਵਾਈ ਤੀ ਕਯਾ ਕਹਿੰਦੇ ਹੁੰਦੇ ਮਲਾਈ ਕੋਫ਼ਤਾ ਪਰ ਬਾਈ ਹਰੇਕ ਹੀ ਚੀਜ਼ ਬਾਹਲੀ ਉਹ ਸਵਾਦ ਹੈ ਸਿਰਾ ਕਰਾਇਆ ਪਿਆ ਤਾ ਪਤੰਦਰਾਂ ਨੇ ਮੈਂ ਤਾਂ ਜਦੋਂ ਤੋਂ ਠਾਣ ਲਈ ਵੀ ਜਦੋਂ ਵੀ ਰੋਟੀ ਪਾਣੀ ਦਾ ਕੰਮ ਹੈ ਕੋਈ ਬਸ ਇਹਨਾਂ ਇਹਨਾਂ ਨੂੰ ਹੀ ਕਹਿਣਾ ਆਪਾਂ ਨੇ ਬੰਦੇ ਵਧੀਆ ਕੰਮ ਕਰਦੇ ਯਾਰ ਵੀ ਰੂਹ ਖੁਸ਼ ਕਰ ਦਿੰਦੇ ਬੰਦੇ ਦੀ ਔਰ ਪੈਕਿੰਗ ਵੀ ਵਧੀਆ ਹੋਈ ਵੀ ਤੀ ਸਮਾਨ ਦੀ ਔਰ ਖਾਣ 'ਚ ਤਾਂ ਲਾਜਵਾਬ ਸਿਰਾ ਕਰਾ ਤਿਆ ਐਂਡ ਗੱਲ ਬਾਤ ਤੀ ਪੂਰੀ ਜਾਣੀ ਕਿ